ਸਤਿ ਸ਼੍ਰੀ ਅਕਾਲ ਮੇਰਾ ਨਾਂ ਅਰਮਾਨਦੀਪ ਸਿੰਘ ਹੈ ਮੈਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਸਾਡੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਿਜਲੀ ਦੀ ਬਹੁਤ ਸਮੱਸਿਆ ਹੈ ਮੈਂ ਜਦੋਂ ਵੀ ਕਿਤੇ ਜਾਣਾ ਹੁੰਦਾ ਹੈ ਤਾਂ ਬਿਜਲੀ ਦੀ ਸਮੱਸਿਆ ਕਾਰਨ ਮੈਂ ਤਿਆਰ ਨਹੀਂ ਹੋ ਸਕਦਾ ਜਦੋਂ ਕਿਤੇ ਮੈਂ ਵਿਆਹ ਸ਼ਾਦੀ 'ਤੇ ਜਾਣਾ ਚਾਹੁੰਦਾ ਹਾਂ ਤਾਂ ਬਿਜਲੀ ਨਾ ਆਉਣ ਕਰਨ ਮੈਂ ਕੱਪੜੇ ਪ੍ਰੈਸ ਨਹੀਂ ਮੇਰੇ ਕੱਪੜੇ ਪ੍ਰੈਸ ਨਹੀਂ ਹੁੰਦੇ ਤਾਂ ਉਹਨਾਂ ਦੇ ਵਿੱਚ ਉਹਨਾਂ ਵਿੱਚ ਵੱਟ ਬਹੁਤ ਪਏ ਹੁੰਦੇ ਹਨ ਤਾਂ ਮੈਨੂੰ ਬਹੁਤ ਸ਼ਰਮ ਆਉਂਦੀ ਹੈ ਜੇ ਕਿਤੇ ਵੀ ਮੈਂ ਜਾਵਾਂ ਕਿਤੇ ਵੀ ਕੁਛ ਸਕੂਲੇ ਜਾਂ ਕਿਤੇ ਮੈਂ ਵਿਆਹ ਸ਼ਾਦੀ ਅਟੈਂਡ ਕਰਨ ਜਾਵਾਂ ਤਾਂ ਮੈਨੂੰ ਬਹੁਤ ਸਮੱਸਿਆ ਆਉਂਦੀ ਹੈ ਅਤੇ ਸਾਡੇ ਨੈਟਵਰਕ ਦੀ ਵੀ ਬਹੁਤ ਸਮੱਸਿਆ ਹੈ ਜਦੋਂ ਵੀ ਜਾਂ ਮੇਰੇ ਬਾਹਰੋਂ ਕਿਸੇ ਚਾਚੇ ਦੇ ਮੁੰਡੇ ਦਾ ਜਾਂ ਕਿਸੇ ਭੂਆ ਦੇ ਮੁੰਡੇ ਦਾ ਬਾਹਰੋਂ ਫੋਨ ਆਉਂਦਾ ਹੈ ਜਾਂ ਵੀਡੀਓ ਕਾਲ ਆਉਂਦੀ ਹੈ ਤਾਂ ਨੈਟਵਰਕ ਨਾ ਆਉਣ ਕਾਰਨ ਮੈਨੂੰ ਬਹੁਤ ਸਮੱਸਿਆ ਆਉਂਦੀ ਹੈ ਵੀਡੀਓ ਕਾਲ ਨਹੀਂ ਵੀਡੀਓ ਕਾਲ 'ਤੇ ਸ ਸਹੀ ਢੰਗ ਨਾਲ ਗੱਲ ਨਹੀਂ ਕੀਤੀ ਜਾਂਦੀ ਇਹ ਬਹੁਤ ਸਾਡੇ ਜ਼ਿਲ੍ਹੇ ਗੁਰਦਾਸਪੁਰ ਵਿੱਚ ਬਹੁਤ ਸਮੱਸਿਆ ਹੈ ਇਹਨਾਂ ਦੀ ਬਿਜਲੀ ਨਾ ਆਉਣ ਕਾਰਨ ਤਾਂ ਬਹੁਤ ਹੀ ਸਾਡੇ ਕਾਰੋਬਾਰਾਂ ਕਾਰੋਬਾਰ ਵਿੱਚ ਨੁਕਸਾਨ ਹੋ ਜਾਂਦਾ ਹੈ ਕਈ ਵਾਰੀ ਤਾਂ ਮੈਨੂੰ ਹੁਣ ਕਈ ਵਾਰੀ ਤਾਂ ਮੈਂ ਫੋਨ ਕਿਸੇ ਨੂੰ ਫੋਨ ਕਰਦਾ ਹਾਂ ਤਾਂ ਫੋਨ ਕਰਦਿਆਂ ਸਮੇਂ ਆਵਾਜ਼ ਕੱਟ ਜਾਂਦੀ ਹੈ ਤਾਂ ਜਿਹੜੀ ਜ਼ਰੂਰੀ ਗੱਲ ਹੁੰਦੀ ਹੈ ਉਹ ਉਹ ਨਹੀਂ ਕੀਤੀ ਜਾਂਦੀ ਤਾਂ ਕਰਕੇ ਮੈਨੂੰ ਗੱਲ ਕਰਨ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ ਮੈਨੂੰ ਬਿਜਲੀ ਨਾ ਆਉਣ ਕਾਰਨ ਨੈਟਵਰਕ ਨਾ ਆਉਣ ਕਾਰਨ ਸਾਡਾ ਕਾਰੋਬਾਰ ਵਿੱਚ ਸਾਨੂੰ ਬਹੁਤ ਹੀ ਮਾੜਾ ਪ੍ਰਯੋਗ ਪ੍ਰਯੋਗ ਹੋ ਰਿਹਾ ਹੈ ਜਿਸ ਕਾਰਨ ਮੈਂ ਕੁਛ ਵੀ ਨਹੀਂ ਕਰ ਸਕਦਾ ਸਹੀ ਢੰਗ ਨਾਲ